ਫੋਟੋਗ੍ਰਾਫੀ ਅਤੇ ਫੋਟੋ ਦੇ ਪ੍ਰਭਾਵ ਚਿੱਤਰਕਾਰੀ ਅਤੇ ਕਲਾ ਉੱਤੇ ਗਹਿਰੀ ਛਾਪ ਛੱਡਦੇ ਹਨ ਇਹ ਦੋਵੇਂ ਮਾਧਿਅਮ ਪਰਸਪੈਕਟਿਵ ਰੰਗ ਚਾਨਣ ਪਰਛਾਵੇਂ ਅਤੇ ਰਚਨਾ ਦੇ ਸੰਕੇਤ ਮੁਹੱਈਆ ਕਰਦੇ ਹਨ ਜੋ ਚਿੱਤਰ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਹਕੀਕਤਨੁਮਾ ਬਣਾਉਂਦੇ ਹਨ ਫੋਟੋਗ੍ਰਾਫਰ ਇੱਕ ਚਿੱਤਰ ਕਲਰ 'ਚ ਕਿਵੇਂ ਮਦਦ ਕਰਦਾ ਹੈ ਉਹ ਕੀ ਉਹਦੇ ਵਿੱਚ ਇਹ ਤਿੰਨ ਚਾਰ ਗੁਣ ਹੁੰਦੇ ਹਨ ਜੋ ਕਿ ਉਹ ਫੋਟੋ ਨੂੰ ਹੋਰ ਵੀ ਪ੍ਰਭਾਵਸ਼ਾਲੀ ਜਾਂ ਉਭਰ ਕੇ ਬਣਾਉਂਦਾ ਹੈ ਸਭ ਤੋਂ ਪਹਿਲੀ ਚੀਜ਼ ਹੈ ਕੰਪੋਜੀਸ਼ਨ ਫੋਟੋ ਵਿੱਚ ਰਚਨਾ ਵਰਤਨ ਦੀ ਤਕਨੀਕ ਇਕ ਚਿੱਤਰਕਾਰ ਨੂੰ ਵੀ ਆਪਣੀ ਕਲਾ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦੀ ਹੈ ਦੂਸਰੀ ਹੈ ਚਾਨਣ ਅਤੇ ਪਰਛਾਵੇਂ ਫੋਟੋ ਵਿੱਚ ਚਾਨਣ ਦੇ ਪ੍ਰਭਾਵ ਨੂੰ ਸਮਝਣ ਨਾਲ ਇੱਕ ਆਰਟਿਸਟ ਚਿੱਤਰ ਵਿੱਚ ਵਧੀਆ ਰੇਂਜ ਲਿਆ ਸਕਦਾ ਹੈ ਔਰ ਤੀਸਰਾ ਹੈ ਦ੍ਰਿਸ਼ਟੀਕੋਣ ਫੋਟੋਗ੍ਰਾਫੀ ਵਿਚ ਵੱਖ ਵੱਖ ਐਂਗਲ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਿਸ ਨਾਲ ਤਸਵੀਰ ਬਹੁਤ ਹੀ ਸੋਹਣੀ ਅਤੇ ਥਰੀ ਡੀ ਦੇਖਣ 'ਚ ਮਿਲਦੀ ਹੈ ਅਤੇ ਮੈਂ ਇਸਨੂੰ ਆਪਣੇ ਕੰਮ ਵਿੱਚ ਕਿਵੇਂ ਲਾਗੂ ਕਰਦੀ ਹਾਂ ਜਿਵੇਂ ਕਿ ਮੈਂ ਕੰਪੋਜੀਸ਼ਨ ਬਣਾਉਣ ਲਈ ਰੈਫਰੇਂਸ ਇਮੇਜਿਸ ਵਰਤਦੀ ਹਾਂ ਮੈਂ ਪ੍ਰਸਪੈਕਟਿਵ ਅਤੇ ਲਾਈਨਿੰਗਸ ਨੂੰ ਸਮਝਣ ਲਈ ਫੋਟੋਜ ਦਾ ਅਧਿਐਨ ਕਰਦੀ ਹਾਂ ਰੰਗਾਂ ਦੀ ਸ਼ੇਡਿੰਗ ਅਤੇ ਪਰਛਾਵੇਂ ਦੀ ਡਿਜੀਟਲ ਇਲਾਸਟਰੇਸ਼ਨ ਵਿੱਚੋਂ ਵਰਤੋਂ ਕਰਦੀ ਹਾਂ ਅਤੇ ਮੈਂ ਇਸਦਾ ਅਭਿਆਸ ਕਰਨ ਲਈ ਕਾਫ਼ੀ ਲੋਕਾਂ ਤੋਂ ਸਿੱਖਦੀ ਹਾਂ ਉਹਨਾਂ ਨਾਲ ਮਿਲਦੀ ਹਾਂ ਤਾਂ ਉਹ ਮੈਨੂੰ ਹਰ ਇਕ ਨਿੱਕੀ ਤੋਂ ਨਿੱਕੀ ਚੀਜ਼ ਫੋਟੋ ਦੇ ਸੰਬੰਧ ਸਮਝਾਉਂਦੇ ਹਨ ਜੋ ਕਿ ਮੇਰੇ ਲੀਏ ਬਹੁਤ ਹੀ ਮਦਦਗਾਰ ਹੁੰਦੀ ਹੈ